ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਤੋਂ ਥੋੜ੍ਹਾ ਸਮਾਂ ਪਹਿਲਾਂ ਆਡਰ ਕੀਤਾ ਸੀ ਅਤੇ ਹੁਣ ਮੈਂ ਇਸ ਆਡਰ ਨੂੰ ਨਹੀਂ ਲੈ ਸਕਦੀ ਅਤੇ ਇਸ ਪ੍ਰੇਸ਼ਾਨੀ ਲਈ ਮੁਆਫ਼ੀ ਚਾਹੁੰਦੀ ਹਾਂ ਅਤੇ ਤੁਸੀਂ ਮੇਰਾ ਆਡਰ ਵਾਪਸ ਲੈ ਲਓ ਮੈਂ ਤੁਹਾਨੂੰ ਆਪਣੇ ਆਡਰ ਦਾ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਸੀ ਕ੍ਰਿਪਾ ਕਰਕੇ ਮੈਨੂੰ ਥੋ ਮੇਰੇ ਬਣਦੇ ਬ ਭੁਗਤਾਨ ਦੇ ਪੈਸੇ ਵਾਪਸ ਕੀਤੇ ਜਾਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰਾ ਆਡਰ ਨੰਬਰ ਵੀਹ ਹੈ ਅਤੇ ਮੈਨੂੰ ਮੇਰਾ ਬਣਦਾ ਰੀਫੰਡ ਵਾਪਸ ਕੀਤਾ ਜਾਵੇ